ਪੰਜਾਬ ਵਿੱਚ ਵੀ ਹੁਣ ਦਿਨੋਂ ਦਿਨ ਅਸੀਂ ਦੇਖ ਰਹੇ ਹਾਂ ਬਹੁਤ ਸਾਰੀਆਂ ਨੀਤੀਆਂ ਜਿਹੜੀਆਂ ਸਰਕਾਰ ਵੱਲੋਂ ਉਹ ਸਾਨੂੰ ਪੰਜਾਬੀਆਂ ਨੂੰ ਦਿੱਤੀਆਂ ਜਾ ਰਹੀਆਂ ਹਨ ਅਤੇ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਜਿਹੜੀ ਪੰਜਾਬ ਵਿੱਚ ਹੈ ਇੰਡਸਟਰੀ ਜਿੰਨੀ ਸੀਗੀ ਉਸ ਤੋਂ ਇਲਾਵਾ ਵੀ ਹੁਣ ਪੰਜਾਬ ਵਿੱਚ ਬਹੁਤ ਸਾਰੀ ਇੰਡਸਟਰੀ ਆ ਰਹੀ ਹੈ ਅਤੇ ਜਿਹਨੂੰ ਪ੍ਰਮੋਟ ਕਰਨ ਲਈ ਵੀ ਬਹੁਤ ਸਾਰੀਆਂ ਐਗਜੀਬਿਸ਼ਨ ਲੱਗਦੀਆਂ ਨੇ ਅਤੇ ਜਿਹੜੀਆਂ ਐਕਸਪੋਰਟ ਆਪਾਂ ਜਿਵੇਂ ਕਰਦੇ ਹਾਂ ਕੁਝ ਆਪਾਂ ਆ ਕੁਝ ਐਕਸਪੋਰਟ ਕਰਨਾ ਹੈ ਉਹ ਸਾਰੇ ਪ੍ਰੋਡਕਟਸ ਜਿਹੜੇ ਉੱਥੇ ਸ਼ੋਕੇਸ ਕੀਤੇ ਜਾਂਦੇ ਨੇ ਅਤੇ ਹਾਂ ਇਹ ਸਾਡਾ ਆਉਣ ਵਾਲੇ ਟਾਈਮ ਵਿੱਚ ਪੰਜਾਬ ਲਈ ਪੰਜਾਬ ਦੀ ਬਿਹਤਰੀ ਲਈ ਅਤੇ ਪੰਜਾਬ ਨੂੰ ਅੱਗੇ ਵਧਾਉਣ ਲਈ ਇਹ ਬਹੁਤ ਜ਼ਿਆਦਾ ਸਹਾਇਕ ਹੋਣਗੀਆਂ ਅਤੇ ਜਿਹੜਾ ਜਿਹੜਾ ਸਾਨੂੰ ਪੰਜਾਬ ਵਿੱਚ ਜਿਸ ਚੀਜ਼ ਦੀਆਂ ਜਿਸ ਇੰਡਸਟਰੀ ਦੀਆਂ ਕਮੀਆਂ ਸੀ ਅਤੇ ਉਹ ਪੰਜਾਬ ਸਰਕਾਰ ਦੇ ਉਪਰਾਲੇ ਦੇ ਨਾਲ ਹੁਣ ਬਹੁਤ ਸਾਰੀਆਂ ਵਿਦੇਸ਼ੀ ਕੰਪਨੀਆਂ ਜਿਹੜੀਆਂ ਹੈ ਉਹ ਵੀ ਇੱਥੇ ਆਪਣੀਆਂ ਸੈਟ ਅਪ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਅਤੇ ਜੋ ਪੰਜਾਬ ਪੰਜਾਬੀਅਤ ਅਤੇ ਸਾਡੇ ਵਾਸਤੇ ਇੱਥੇ ਬਹੁਤ ਜ਼ਿਆਦਾ ਅੱਛਾ ਹੈ ਕਿਉਂਕਿ ਇਹਦੇ ਨਾਲ ਸਾਡਾ ਜਿਹੜਾ ਅਨਇਮਪਲੋਇਮੈਂਟ ਹੈਗੀ ਹੈ ਉਹਦੀ ਸਮੱਸਿਆ ਦੂਰ ਹੋਏਗੀ ਲੋਕਾਂ ਨੂੰ ਉਹਦੇ ਨਾਲ ਜੋਬਸ ਮਿਲਣਗੀਆਂ ਇੰਪਲੋਇਮੈਂਟ ਮਿਲਣਗੀ ਅਤੇ ਸਾਰੇ ਪਾਸੇ ਜਿਹੜਾ ਹੈ ਪੰਜਾਬੀ ਜਿਹੜੀ ਆ ਅੱਗੇ ਵਾਂਗੂ ਹੀ ਹੋਰ ਖੁਸ਼ਹਾਲ ਹੋ ਜਾਏਗਾ